ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ ਮੈਂ ਨਿਰਮਲ ਕੌਰ ਜ਼ਿਲ੍ਹਾ ਲੁਧਿਆਣਾ ਤੋਂ ਬੋਲ ਰਹੀ ਹਾਂ ਮੈਂ ਐਮਾਜ਼ੋਨ ਦੀ ਸਾ ਵੈਬਸਾਈਟ ਤੋਂ ਇੱਕ ਕੂਲਰ ਗਰਮੀਆਂ ਵਿੱਚ ਠੰਡੀ ਹਵਾ ਦੇਣ ਵਾਲਾ ਕੂਲਰ ਨੀਲੇ ਰੰਗ ਦਾ ਆਡਰ ਕੀਤਾ ਸੀ ਪਹਿਲਾਂ ਤਾਂ ਉਸ ਦੀ ਔਨਲਾਈਨ ਡਿਲੀਵਰੀ ਲੇਟ ਵੀ ਹੋ ਗਈ ਜਿਸ ਮਿਤੀ 'ਤੇ ਆਉਣਾ ਸੀ ਉਸ ਮਿਤੀ 'ਤੇ ਨਹੀਂ ਪਹੁੰਚਿਆ ਜਿਸ ਨਾਲ ਮੈਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਹੈ ਭਾਅ ਜੀ ਉਸ ਦੇ ਨਾਲ ਨਾਲ ਜਦੋਂ ਉਹ ਮਿਤੀ ਤੋਂ ਲੇਟ ਆਇਆ ਤਾਂ ਮੈਂ ਜਦੋਂ ਖੋਲ੍ਹ ਕੇ ਵੇਖਿਆ ਤਾਂ ਉਹ ਉਸਦੇ ਇੱਕ ਪਰ ਜਿਹੜਾ ਹੈ ਉਹ ਟੁੱਟਾ ਪਿਆ ਸੀ ਅਤੇ ਜਿਹੜੇ ਰੰਗ ਦਾ ਵੀ ਮੈਂ ਮੰਗਾਇਆ ਸੀ ਉਹ ਵੀ ਨਹੀਂ ਸੀ ਉਸ ਤੋਂ ਉਪਰੋਕਤ ਕੋਈ ਹੋਰ ਹੀ ਰੰਗ ਸੀ ਅਤੇ ਜਦੋਂ ਮੈਂ ਦੇਖਿਆ ਤਾਂ ਉਸਦਾ ਪਰ ਟੁੱਟਾ ਪਿਆ ਸੀ ਅਤੇ ਮੈਨੂੰ ਇਸ ਬਾਰੇ ਕੁਛ ਵਾਪਸ ਕਰਨ ਦੇ ਬਾਰੇ ਕੋਈ ਜਾਣਕਾਰੀ ਪ੍ਰਦਾਨ ਕਰੋ ਤਾਂ ਜੋ ਮੈਂ ਇਹ ਇਸ ਨੂੰ ਵਾਪਸ ਕਰ ਸਕਾਂ ਅਤੇ ਮੇਰੇ ਪੈਸੇ ਵੀ ਰਿਫੰਡ ਕੀਤੇ ਜਾਣ